ਮੇਰਾ ਮਨਪਸੰਦ ਕਲਾਕਾਰ ਦਿਲਜੀਤ ਦੋਸਾਂਝ ਹੈ ਉਸਦੇ ਗਾਏ ਗਾਣੇ ਮੈਨੂੰ ਬਹੁਤ ਪਸੰਦ ਹਨ ਵਿਹਲੇ ਸਮੇਂ ਵਿੱਚ ਉਸਦੇ ਗਾਣੇ ਸੁਣਦੀ ਰਹਿੰਦੀ ਹਾਂ ਉਸ ਨੇ ਪੰਜਾਬੀ ਲੋਕ ਸੰਗੀਤ ਨੂੰ ਬਹੁਤ ਉੱਪਰ ਚੁੱਕਿਆ ਹੋਇਆ ਹੈ ਉਹ ਇੱਕ ਗੀਤਕਾਰ ਦੇ ਨਾਲ ਨਾਲ ਪੰਜਾਬੀ ਐਕਟਰ ਵੀ ਹੈ ਉਸ ਨੇ ਬਹੁਤ ਸਾਰੀ ਫਿਲਮਾਂ ਵਿੱਚ ਕੰਮ ਵੀ ਕੀਤਾ ਹੋਇਆ ਹੈ ਸਭ ਤੋਂ ਵਧੀਆ ਕਿਰਦਾਰ ਉਸਦਾ ਮੈਨੂੰ ਫਿਲਮ ਪੰਜਾਬ ਉੱਨੀ ਸੌ ਚੁਰਾਸੀ ਵਿੱਚ ਲੱਗਿਆ ਉਹ ਇੱਕ ਮਸ਼ਹੂਰ ਗੀਤਕਾਰ ਹੋਣ ਦੇ ਨਾਲ ਨਾਲ ਇੱਕ ਚੰਗਾ ਇਨਸਾਨ ਵੀ ਹੈ ਉਸ ਨੇ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਦੀ ਪਹਿਚਾਣ ਬਣਾਈ ਹੈ